ਭੰਗੜਾ ਪੰਜਾਬ ਦੇ ਦੋ ਮੁੱਖ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ ਦੂਜਾ ਨਾਚ ਗਿੱਧਾ ਗੱਭਰੂਆਂ ਭੰਗੜਾ ਨਾਚ ਅਤੇ ਜਦੋਂ ਕਿ ਮੁਟਿਆਰਾਂ ਗਿੱਧਾ ਪਾਉਂਦੀਆਂ ਹਨ ਭੰਗੜਾ ਤਕਰੀਬਨ ਹਰ ਖੁਸ਼ੀ ਦੇ ਮੌਕੇ ਪਾਇਆ ਜਾਂਦਾ ਜਿਨ੍ਹਾਂ ਵਿੱਚੋਂ ਜਿਵੇਂ ਹਾੜ੍ਹੀ ਦੀ ਫ਼ਸਲ ਵੇਲੇ ਵਾਢੀ ਵਿਸਾਖੀ ਦੇਖਣ ਲਈ ਜੱਟ ਮੇਲੇ 'ਤੇ ਜਾਂਦੇ ਹਨ ਵਿਆਹ ਮੰਗਣੇ ਅਤੇ ਤਿਉਹਾਰਾਂ ਦੇ ਵਿੱਚ ਆਮ ਸ਼ਾਮਲ ਹੁੰਦੇ ਹਨ ਇਹ ਲੋਕ ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਦਾ ਪ੍ਰਾਚੀਨ ਹੈ ਵਿਗਿਆਨੀ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ ਇਹ ਪਹਿਲਾ ਪਹਿਲਾਂ ਜਦੋਂ ਪੰਜਾਬ ਦੇ ਪੰਜਾਬ ਨੇ ਹਰੀਆਂ ਫ਼ਸਲਾਂ ਦਾ ਸੁਨਹਿਰੀ ਸਿੱਟੇ ਵਜੋਂ ਪੇਈਆਂ ਪੈਂਦੇ ਵੇਖੇ ਇਹਨਾਂ ਉਨ੍ਹਾਂ ਦਾ ਮਨ ਹੁਲਾਰੇ ਵਿੱਚ ਨੱਚ ਖਲੋਤਾ ਹੈ ਕਰੜੀ ਮਿਹਨਤ ਨੂੰ ਸੁਨਹਿਰੀ ਫ਼ਲ ਲੱਗਿਆ ਵੇਖ ਕੇ ਕਿਸ ਦਾ ਦਿਲ ਨਹੀਂ ਨੱਚਣ ਨੂੰ ਉੱਠਦਾ ਮੁੱਢ ਵਿੱਚ ਇਹ ਨਾਚ ਫ਼ਸਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰੀਤੀ ਰਸਮਾਂ ਸਮੇਂ ਖੁੱਲ੍ਹੇ ਖੇਤਾਂ ਵਿੱਚ ਨੱਚਿਆ ਜਾਂਦਾ ਸੀ ਪੱਛਮੀ ਗੁਜਰਾਤ ਅਤੇ ਸਿਆਲਕੋਟ ਵਿੱਚ ਜ਼ਿਆਦਾ ਪ੍ਰਚਲਿੱਤ ਸੀ ਇਸ ਨਾਚ ਦਾ ਸੰਬੰਧ ਵਿਸਾਖੀ ਸਮੇਂ ਜ ਕਣਕ ਦੀ ਵਾਢੀ ਨਾਲ ਹੈ ਉਸ ਸਮੇਂ ਲੋਕ ਖੁਸ਼ੀ ਵਿੱਚ ਭੰਗੜਾ ਪਾਉਂਦੇ ਸਨ ਭੰਗੜੇ ਵਿੱਚ ਪੇਂਡੂ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਢੋਲ ਢਮੱਕੇ ਦਾ ਸ ਮੁੱਖ ਸਾਜ਼ ਹੈ ਇਸ ਤੋਂ ਬਿਨਾਂ ਲੋਕ ਸਾਜ਼ ਜਿਵੇਂ ਬੁਗਚੂ ਅਲਮੋਜੇ ਸੱਪ ਕਰਾਟੋ ਕਾਟੋ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ ਭੰਗੜੇ ਵਿੱਚ ਢੋਲੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਸੀ ਲੋਕ ਢੋਲੀ ਦੇ ਦੁਆਲੇ ਘੇਰਾ ਬਣਾ ਲੈਂਦੇ ਸਨ ਤਾਲ ਦੇ ਉੱਪਰ ਕਦੇ ਮੋਢੇ ਹਿਲਾਉਂਦੇ ਕਦੇ ਗੋਡੇ ਅੱਗੇ ਵਧਾ ਕੇ ਸਰੀਰ ਨੂੰ ਝੁਕਾ ਲੈਂਦੇ ਸੀ ਅਤੇ ਫਿਰ ਸਾਰਾ ਸਰੀਰ ਤਾਲ ਵਿੱਚ ਬੱਝ ਜਾਂਦਾ ਸੀ ਤਾਲ ਹੌਲੀ ਹੌਲੀ ਤੇਜ਼ ਹੁੰਦਾ ਜਾਂਦਾ ਅਤੇ ਜਿਸ ਨਾਲ ਸਰੀਰ ਦੀਆਂ ਅਦਾਵਾਂ ਤੇਜ਼ ਹੋ ਜਾਂਦੀਆਂ ਸਨ ਭੰਗੜੇ ਦੀ ਤਾਲ ਨਹੀਂ ਟੁੱਟਣ ਦੇਣੀ ਚਾਹੀਦੀ ਸੀ ਇਸ ਵਿੱਚ ਭੰਗੜੇ ਦਾ ਢੋਲ ਦੀ ਤਾਲ ਉੱਤੇ ਸਰੀਰ ਕਰਤੱਬ ਵੀ ਦਿਖਾਏ ਜਾਂਦੇ ਸਨ ਜਿਸ ਵਿੱਚ ਕਾਟੋ ਵਜਾਉਣੀ ਸਲੱਪੇ ਮਾਰਨੇ ਮੁੱਖ ਸਨ ਵਿਆਹਾਂ ਸ਼ਾਦੀਆਂ ਵਿੱਚ ਵੀ ਭੰਗੜੇ ਦਾ ਮੁੱਖ ਨਾਚ ਨਚਾਮਾ ਕੀਤਾ ਜਾਂਦਾ ਹੈ ਅੱਜ ਕੱਲ੍ਹ ਦੇ ਟਾਈਮ ਵਿੱਚ ਵੀ ਜਾਗੋਆਂ 'ਤੇ ਵਿਆਹਾਂ ਸ਼ਾਦੀਆਂ ਵਿੱਚ ਆਮ ਮੁਟਿਆਰਾਂ ਬੋਲੀਆਂ ਭੰਗੜੇ ਗਿੱਧੇ ਪਾ ਕੇ ਨਾਚ ਕਰਦੀਆਂ ਸਨ ਪੰਜਾਬ ਦੇ ਵਿਹੜੇ ਵਿੱਚ ਹੁਣ ਭੰਗੜੇ ਦੀ ਧਮਾਲ ਨਹੀਂ ਪੈਂਦੀ ਹੁਣ ਨਾ ਸੈਲ ਸਬੀਲੇ ਗੱਭਰੂ ਲੱਭਦੇ ਨੇ ਅਤੇ ਨਾ ਹੀ ਜੇਬ ਭਾਰ ਝੱਲਦੀ ਹੈ ਜੋ ਪੰਜਾਬ ਕਦੇ ਖੁਦ ਨੱਚਦਾ ਸੀ ਉਸਨੂੰ ਪੱਬਾਂ ਹੇਠ ਪਰਖੇਜ ਭੋ ਵੀ ਨਹੀਂ ਰਹੀ ਕਹਿੰਦੇ ਅਕਸਰ ਨਸ਼ਿਆਂ ਵਿੱਚ ਹੀ ਕੱਢ ਦਿੱਤੀ ਗਈ ਗੁੱਸੇ ਵਾਲੀ ਜਵਾਨੀ ਲੱਭਣੀ ਵੀ ਸੌਖੀ ਨਹੀਂ ਬਾਕੀ ਬਜ਼ਾਰ ਖਿਸਕ ਕੇ ਲੋਕ ਨਾਚ ਭੰਗੜੇ ਦੀ ਨੁਹਾਰ ਖੋਹ ਲਈ ਹੈ